ਚਿੱਤਰਕਾਰੀ ਜੋ ਇੱਕ ਬਹੁਤ ਹੀ ਮਸ਼ਹੂਰ ਕਲਾ ਹੈ ਜੋ ਕਿ ਪੁਰਾਣੇ ਜ਼ਮਾਨੇ ਤੋਂ ਹੀ ਲੋਕ ਕਰਦੇ ਆ ਰਹੇ ਹਨ ਪਰ ਸ਼ੁਰੂ ਵਿੱਚ ਇਸ ਵਿੱਚ ਬਹੁਤ ਹੀ ਗਲਤੀਆਂ ਹੁੰਦੀਆਂ ਹਨ ਜਿਵੇਂ ਕਿ ਸਾਡੇ ਤੋਂ ਸਹੀ ਤਰੀਕੇ ਨਾਲ ਸਿੱਧੀਆਂ ਲਾਈਨਾਂ ਵੀ ਨਹੀਂ ਖਿੱਚੀਆਂ ਜਾਂਦੀਆਂ ਕਈ ਵਾਰ ਸਾਨੂੰ ਰੰਗਾਂ ਬਾਰੇ ਵੀ ਨਹੀਂ ਪਤਾ ਚੱਲਦਾ ਕਿ ਅਸੀਂ ਕਿਸ ਵਿੱਚ ਕਿਹੜਾ ਰੰਗ ਭਰਨਾ ਹੈ ਅਤੇ ਕਿਸ ਰੰਗ ਦੀ ਕਦੋਂ ਵਰਤੋਂ ਕਰਨੀ ਹੈ ਇਹਨਾਂ ਤੋਂ ਬਚਣ ਲਈ ਸਾਨੂੰ ਚੰਗੀ ਤਰ੍ਹਾਂ ਚਿੱਤਰਕਾਰੀ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਕਿਸੇ ਜਾਣਕਾਰ ਬੰਦੇ ਤੋਂ ਚਿੱਤਰਕਾਰ ਸਿੱਖ ਵੀ ਸਕਦੇ ਹਾਂ ਇਸ ਲਈ ਬਹੁਤ ਸਾਰੇ ਕੇਂਦਰ ਬਣਾਏ ਜਾਂਦੇ ਹਨ ਜਿੱਥੇ ਕਿ ਚਿੱਤਰਕਾਰੀ ਸਿਖਾਈ ਜਾਂਦੀ ਹੈ ਹੁਣ ਤਾਂ ਸਕੂਲਾਂ ਵਿੱਚ ਵੀ ਚਿੱਤਰਕਾਰੀ ਨੂੰ ਸਿਖਾਇਆ ਜਾਂਦਾ ਹੈ ਇੱਕ ਚੰਗੇ ਕਲਾਕਾਰ ਬਣਨ ਲਈ ਸਾਨੂੰ ਬਹੁਤ ਅਭਿਆਸ ਦੀ ਲੋੜ ਹੈ ਇਸ ਲਈ ਸਾਨੂੰ ਇਸ ਦੀ ਰੋਜ਼ ਪ੍ਰੈਕਟਿਸ ਕਰਨੀ ਪੈਂਦੀ ਹੈ ਅਤੇ ਸਾਨੂੰ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ ਸਾਨੂੰ ਲੋੜ ਹੈ ਕਿ ਅਸੀਂ ਅਸੀਂ ਦਿਲ ਲਗਾ ਕੇ ਸਿੱਖੀਏ ਤੇ ਜਦੋਂ ਤੱਕ ਅਸੀਂ ਇਸ ਵਿੱਚ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਸਿੱਖ ਨਹੀਂ ਜਾਂਦੇ ਉਦੋਂ ਤੱਕ ਅਸੀਂ ਮਿਹਨਤ ਕਰਦੇ ਰਹੀਏ ਅਤੇ ਫਿਰ ਹੀ ਅਸੀਂ ਇੱਕ ਚੰਗੇ ਕਲਾਕਾਰ ਬਣ ਸਕਦੇ ਹਾਂ ਇਸ ਲਈ ਹਰ ਇੱਕ ਕੰਮ ਵਿੱਚ ਮਿਹਨਤ ਕਰਨ ਦੀ ਬਹੁਤ ਲੋੜ ਹੈ